ਬਹੁਤ ਸਾਰੇ ਵੱਖਰੇ ਵੱਖਰੇ ਭੋਜਨ ਹਨ ਜਿਹਨਾਂ ਨੂੰ ਮੈਂ ਖਾਣਾ ਪਸੰਦ ਕਰਦੀ ਹਾਂ ਜਿਵੇਂ ਕਿ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਇਹ ਪੰਜਾਬੀਆਂ ਦੇ ਪਹਿਲੀ ਮਨਪਸੰਦ ਭੋਜਨ ਹ ਹੈ ਇਹ ਇਹ ਪੰਜਾਬੀ ਬਹੁਤ ਹੀ ਖਾਣਾ ਪਸੰਦ ਕਰਦੇ ਹਨ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਾਣ ਵਿੱਚ ਵੀ ਬਹੁਤ ਸਿਹਤਮੰਦ ਹੈ ਇਹ ਖਾ ਕੇ ਵੀ ਇੰਨਾਂ ਹੈ ਭਾਰਾ ਫੀਲ ਨਹੀਂ ਹੁੰਦਾ ਇਹ ਸੌਖੇ ਤਰੀਕੇ ਨਾਲ ਪਚ ਜਾਂਦਾ ਹੈ ਅਤੇ ਮੈਂ ਇਹਨੂੰ ਬਹੁਤ ਹੀ ਖਾਣਾ ਪਸੰਦ ਕਰਦੀ ਹਾਂ ਮਿੱਠੇ ਵਿੱਚ ਮੈਂ ਖੀਰ ਕਸਟਰਡ ਗੁਲਾਬ ਜਾਮੁਨ ਨੂੰ ਪਸੰਦ ਕਰਦੀ ਹਾਂ ਕਸਟਰਡ ਮੇਰਾ ਫੇਵਰਟ ਹੈ ਮੇਰੇ ਮੇਰਾ ਮੇਰਾ ਜਦੋਂ ਵੀ ਮਿੱਠਾ ਖਾਣ ਦਾ ਮਨ ਕਰੇ ਮੈਂ ਹਰ ਟਾਈਮ ਕਸਟਰਡ ਜਾਂ ਖੀਰ ਬਣਾ ਲੈਂਦੀ ਹਾਂ ਕਸਟਰਡ ਵਿੱਚ ਮੈਂ ਵੱਖਰੇ ਵੱਖਰੇ ਤਰ੍ਹਾਂ ਦੇ ਫਲ ਫਰੂਟ ਪਾਉਣਾ ਪਸੰਦ ਕਰਦੀ ਹਾਂ ਜਿਸ ਨਾਲ ਇਹ ਹੋਰ ਵੀ ਸਿਹਤਮੰਦ ਬਣ ਜਾਂਦਾ ਹੈ ਅਤੇ ਇਸ ਨੂੰ ਖਾਣ ਵਿੱਚ ਵੀ ਬਹੁਤ ਹੀ ਸਵਾਦ ਆਉਂਦਾ ਹੈ ਫਾਸਟ ਫੂਡ ਦੀ ਗੱਲ ਕੀਤੀ ਜਾਵੇ ਅਤੇ ਮੈਗੀ ਪਾਸਤਾ ਪਕੌੜੇ ਮਨਚੂਰੀਅਨ ਨਿਊਡਲਸ ਇਹ ਸਭ ਚੀਜ਼ਾਂ ਮੇਰੀਆਂ ਬਹੁਤ ਹੀ ਮਨਪਸੰਦ ਹਨ ਇਹਨਾਂ ਨੂੰ ਮੈਂ ਆਪਣੇ ਵਿਹਲੇ ਟਾਈਮ ਵਿੱਚ ਖਾਣਾ ਪਸੰਦ ਕਰਦੀ ਹਾਂ ਕਿਉਂਕਿ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਹਨ ਅਤੇ ਬਹੁਤ ਹੀ ਸਵਾਦ ਵੀ ਲੱਗਦੇ ਹਨ ਜਦੋਂ ਵੀ ਮੇਰਾ ਕੁਝ ਤਿੱਖਾ ਖਾਣ ਦਾ ਮਨ ਕਰੇ ਤਾਂ ਮੈਂ ਮੈਗੀ ਪਾਸਤਾ ਪਕੌੜੇ ਮਨਚੂਰੀਅਨ ਨਿਊਡਲਸ ਇਹਨਾਂ ਵਿੱਚੋਂ ਕੋਈ ਚੀਜ਼ ਬਣਾ ਲੈਂਦੀ ਹਾਂ ਕਿਉਂਕਿ ਇਹ ਮੇਰੇ ਬਹੁਤ ਹੀ ਮਨ ਪਸੰਦੀਦਾ ਭੋਜਨ ਹਨ